ਗੱਲ ਕਰੀਏ ਕੰਮ ਦੀ ਤਾਂ ਮੈਂ ਰੋਜ਼ ਆਪਣੇ ਖ਼ੁਦ ਨੌ ਵਜੇ ਘਰ ਤੋਂ ਚਲਿਆ ਜਾਂਦਾ ਹਾਂ ਅਤੇ ਮੇਰੀ ਜੋਬ ਦੀ ਗੱਲ ਕਰੀਏ ਤਾਂ ਮੇਰੀ ਬਹੁਤ ਵਧੀਆ ਜੋਬ ਹੈ ਸੀਟਿੰਗ ਅਤੇ ਕੰਮ ਮੇਰਾ ਜ਼ਿਆਦਾ ਕਰਕੇ ਅਕਾਊਂਟਸ ਦਾ ਹੈ ਅਤੇ ਉਸਦੇ ਵਿੱਚ ਗੱਲ ਕਰੀਏ ਕੈਰੀਅਰ ਮੈਂ ਇਹ ਕਿੱਦਾਂ ਫੈਸਲਾ ਕੀਤਾ ਜਦੋ ਮੈਂ ਆਪਣੀ ਐੱਮ ਕੋਮ ਕਲੀਅਰ ਕੀਤੀ ਤਾਂ ਉਸ ਤੋਂ ਬਾਅਦ ਮੈਂ ਅਖਬਾਰ ਦੇ ਵਿੱਚ ਇੱਕ ਐਡ ਦੇਖੀ ਜਿਸ ਰਾਹੀਂ ਇਹ ਮੈਨੂੰ ਜੋਬ ਦਾ ਮੇਰੀ ਦਾ ਪਤਾ ਲੱਗਿਆ ਅਤੇ ਮੈਂ ਇੰਟਰਵਿਊ ਕਲੀਅਰ ਕੀਤੀ ਅਤੇ ਫਿਰ ਮੈਂ ਸਿਲੈਕਟ ਹੋ ਗਿਆ